ਹੈਲੋਏ ਹਾਂਜੀ ਤੁਸੀਂ ਓਲਾ ਤੋਂ ਬੋਲ ਰਹੇ ਜੀ ਹਾਂਜੀ ਅਸੀਂ ਨਾ ਇੱਕ ਕੈਬ ਬੁੱਕ ਕਰਾਉਣੀ ਸੀ ਤੁਹਾਡੇ ਉਹ ਰਿਸ਼ਤੇਦਾਰ ਨੇ ਅੰਬਾਲੇ ਅਤੇ ਉਹਨਾਂ ਨੇ ਇੱਥੇ ਅੰਮ੍ਰਿਤਸਰ ਆਉਣਾ ਜੀ ਅਤੇ ਉਹਦੇ ਬਾਰੇ ਤੁਸੀਂ ਮੈਨੂੰ ਜਾਣਕਾਰੀ ਦੇ ਦਿਓ ਅਤੇ ਨਾਲੇ ਤੁਸੀਂ ਆਪਣੇ ਡਰਾਈਵਰ ਦਾ ਨੰਬਰ ਦੇ ਦਿਓ ਡਰਾਈਵਰ ਦਾ ਨਾਮ ਦੱਸ ਦਿਓ ਅਤੇ ਉਹਨਾਂ ਨੂੰ ਅਸੀਂ ਜਿਹੜਾ ਡਰਾਈਵਰ ਉਹਨਾਂ ਨੂੰ ਸਮਝਾ ਦਿਆਂਗੇ ਕਿ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਰਸਤਾ ਵਾ ਅਤੇ ਕਿੱਧਰ ਆਉਣ ਵਾ ਅਤੇ ਤੁਸੀਂ ਮਿਹਰਬਾਨੀ ਕਰਕੇ ਸਾਨੂੰ ਇਹ ਦੱਸ ਦਿਓ ਅਤੇ ਨਾਲੇ ਸਾਨੂੰ ਇਹਦਾ ਜੋ ਵੀ ਕਿਰਾਇਆ ਹੈ ਉਹ ਸਾਨੂੰ ਦੱਸਿਓ ਅਤੇ ਅਸੀਂ ਤੁਹਾਡੀ ਕੈਬ ਬੁੱਕ ਕਰਵਾ ਸਕੀਏ ਮਿਹਰਬਾਨੀ ਕਰਕੇ ਤੁਸੀਂ ਇਹ ਜਿਹੜਾ ਜੋ ਵੀ ਹੈਗਾ ਸੀ ਤੁਹਾਡਾ ਆਪਣਾ ਰਸਤੇ ਦੇ ਵਿੱਚ ਟੋਲ ਆ ਉਹ ਵੀ ਸਾਰਾ ਕੁਛ ਸਾਨੂੰ ਦੱਸਿਓ ਕਿ ਕੀ ਕੀ ਖਰਚੇ ਨੇ ਇਹਦੇ ਇਸ ਤੋਂ ਇਲਾਵਾ ਹੋਰ ਜੇ ਕੋਈ ਡਰਾਈਵਰ ਦਾ ਖਰਚਾ ਹੈ ਤੇ ਉਹ ਵੀ ਦੱਸਿਓ ਮਿਹਰਬਾਨੀ ਕਰਕੇ ਤੁਸੀਂ ਮੈਨੂੰ ਇਹ ਜਾ ਜਾਣਕਾਰੀ ਦੇ ਦਿਓ ਕਿਉਂਕਿ ਮੈਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਕੋਲ ਬੁਲਾਉਣਾ ਹੈ ਥੈਂਕ ਯੂ ਜੀ